ਭੰਗੜੇ ਦੇ ਕੁਝ ਆਮ ਸਟੈਪ ਜਿਵੇਂ ਕਿ ਲੂਡੀ ਝੂਮਰ ਧਮਾਲ ਗਮ ਲੂਡੀ ਇਹ ਅਜਿਹੇ ਭੰਗੜੇ ਪੰਜਾਬੀ ਸੱਭਿਆਚਾਰ ਦੇ ਜੋਰ ਦਾ ਜਸ਼ਨ ਵਾਲੇ ਸੁਭਾਅ ਵਿੱਚ ਕੁਝ ਇਸ ਤਰ੍ਹਾਂ ਯੋਗਦਾਨ ਪਾਉਂਦੇ ਹਨ ਕਿ ਜਿਸ ਕੋਈ ਵਿਸਾਖੀ ਦਾ ਫੈਸਟੀਵਲ ਹੋਵੇ ਉਸ ਦੌਰਾਨ ਭੰਗੜੇ ਨਾਲ ਜਿਹੜੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਉਹਨਾਂ ਨਾਲ ਆਪਣਾ ਕੀ ਕਲਚਰ ਨਾਲ ਜੁੜਨ ਦਾ ਇੱਕ ਮੌਕਾ ਲੱਭਦਾ ਆਪਾਂ ਨੂੰ ਠੀਕ ਹੈ ਅਤੇ ਜਿਵੇਂ ਭੰਗੜੇ ਵਿੱਚ ਅਲੱਗ ਅਲੱਗ ਆਪਣਾ ਕਲਚਰ ਆ ਜਿਹੜਾ ਇਕ ਉਹ ਸਥਾਪਿਤ ਹੁੰਦਾ ਹੈ ਠੀਕ ਹੈ ਇੱਕ ਤਰ੍ਹਾਂ ਦਾ ਫੋਕ ਡਾਂਸ ਰਿਹਾ ਪੰਜਾਬ ਦਾ ਜਿਹੜਾ ਕਿ ਸਿ ਪਾਕਿਸਤਾਨ ਦੇ ਏਰੀਆ ਸਿਆਲਕੋਟ ਸੋ ਇਹਦੀ ਹੋਂਦ ਮਤਲਬ ਓਰਿਜਨੇਟ ਹੋਇਆ ਇਹ ਦੋ ਵਿਸਾਖੀ ਦੇ ਫੈਸਸੀਵਲ ਦੌਰਾਨ ਠੀਕ ਹੈ ਉਦੋਂ ਆਪਾਂ ਨੂੰ ਭੰਗੜੇ ਨਾਲ ਜੁੜਨ ਦਾ ਮੌਕਾ ਮਿਲਦਾ ਠੀਕ ਹੈ ਹੁਣ ਨਾਲ ਆਪਣੇ ਨੂੰ ਆਪਣੇ ਕਲਚਰ ਬਾਰੇ ਥੋੜ੍ਹਾ ਬਹੁਤ ਗਿਆਨ ਹੁੰਦਾ ਹੁਣ ਭੰਗੜੇ ਵਿੱਚ ਅਲੱਗ ਅਲੱਗ ਸਟੈਪਸ ਜਿਵੇਂ ਸਿੰਗਲ ਚਫਾ ਡਬਲ ਚਫਾ ਅਤੇ ਪੰਜਾਬ ਇਹਦਾ ਆ ਜਾਂਦਾ ਠੀਕ ਹੈ ਹੁਣ ਜੇ ਕੋਈ ਸ਼ੁਰੂਆਤ 'ਚ ਸਿੱਖਣ ਵਾਲਾ ਭੰਗੜਾ ਵਾਲਾ ਹੈਗਾ ਇਹਦੇ ਨਾਲ ਕੀ ਆਪਣੇ ਹੱਥ ਪੈਰ ਠੀਕ ਹੈ ਦੀਆਂ ਗਤੀਵਿਧੀਆਂ ਨੇ ਆਪਣੀ ਜਿਹੜੀ ਲੈਗਸ ਦੇ ਮਸਲਜ਼ 'ਤੇ ਟੋਨ ਬਣਦੀ ਠੀਕ ਹੈ ਸ਼ੇਪ ਵਗੈਰਾ ਦਿੱਤੀ ਜਾਂਦੀ ਨਾਲੇ ਇਹਦੇ ਨਾਲ ਕੀ ਹੈ ਆਪਣੇ ਇੱਕ ਵਰਕਆਊਟ ਵੀ ਹੋ ਜਾਂਦਾ ਠੀਕ ਹੈ ਆਪਣੀ ਫਿਟਨੈਸ ਵੀ ਮੈਨਟੇਨ ਰਹਿ ਸਕਦੀ ਇਹਦੇ ਨਾਲ ਸੋ ਇਸ ਤਰ੍ਹਾਂ ਆਪਾਂ ਇੱਦਾਂ ਭੰਗੜੇ ਦੇ ਵਿੱਚ ਆਪਾਂ ਦੇਖ ਰਹੇ ਇੰਨੇ ਯੋਗਦਾਨ ਹੋ ਸਕਦੇ ਇਸ ਨਾਲ ਸਾਨੂੰ ਠੀਕ ਹੈ